ਸਤਿ ਸ਼੍ਰੀ ਅਕਾਲ ਜੀ ਮੀਸ਼ੋ ਤੋਂ ਬੋਲਦੇ ਜੀ ਹਾਂਜੀ ਤੁਹਾਡੇ ਤੋਂ ਕੱਪੜੇ ਲਏ ਸੀਗੇ ਹਾਂਜੀ ਕੱਪੜੇ ਮਿਲ ਗਏ ਤੇ ਜੀ ਡਿਲੀਵਰੀ ਬੋਏ ਕੱਪੜੇ ਫੜਾ ਗਿਆ ਤਾ ਕੱਪੜਿਆਂ ਦੀ ਪੈਕਿੰਗ ਬੜੀ ਸੋਹਣੀ ਸੀਗੀ ਔਰ ਕੱਪੜੇ ਜਦੋ ਖੋਲ੍ਹ ਕੇ ਦੇਖੇ ਸਾਈਜ ਪਰੋਪਰ ਫਿੱਟ ਸੀਗਾ ਕਲਰ ਬੜਾ ਸੋਹਣਾ ਸੀਗਾ ਔਰ ਤੁਹਾਡੇ ਡਿਲੀਵਰੀ ਬੋਏ ਦਾ ਨੇਚਰ ਕਾਫ਼ੀ ਅੱਛਾ ਸੀਗਾ ਔਰ ਉਹਨਾਂ ਨੇ ਕੱਪੜੇ ਦੇਣ ਤੋਂ ਬਾਅਦ ਪੇੈਸਿਆਂ ਪੈਸੇ ਮੇਰੇ ਕੋਲ ਕੈਸ਼ ਨਹੀਂ ਸੀਗੇ ਤਾਂ ਮੈਂ ਗੂਗਲ ਪੇਅ ਕਰਤੇ ਔਰ ਉਨ੍ਹਾਂ ਦਾ ਸੁਭਾਅ ਕਾਫ਼ੀ ਅੱਛਾ ਸੀਗਾ ਮੈਂ ਅੱਗੇ ਤੋਂ ਕੱਪੜੇ ਤੁਹਾਡੇ ਕੋਲ਼ੋਂ ਹੀ ਲਿਆ ਕਰਾਂਗਾ ਧੰਨਵਾਦ